ਇਹ ਜਿਹੜੀਆਂ ਬਿਮਾਰੀਆਂ ਆਪਣੇ ਲਈ ਬਹੁਤ ਵਧੀਆ ਪਈਆਂ ਦਿਮਾਗੀ ਟੈਸ਼ਨ ਹੋ ਗਈ ਜਾਂ ਕੋਈ ਕਿਸੇ ਵਜ੍ਹਾ ਦੀ ਕੋਈ ਚਿੰਤਾ ਹੋ ਗਈ ਆਪਣੇ ਲਈ ਬਹੁਤ ਮਾੜੀਆਂ ਇਹ ਅਤੇ ਫਿਰ ਆਪਾਂ ਨੂੰ ਹਸਪਤਾਲਾਂ 'ਚ ਜਾਣਾ ਪੈਂਦਾ ਉੱਥੋਂ ਦਵਾਈਆਂ ਲੈਣੀਆਂ ਪੈਂਦੀਆਂ ਦਵਾਈਆਂ ਲਿਆ ਕੇ ਖਾਣੀਆਂ ਪੈਂਦੀਆਂ ਅਤੇ ਦਵਾਈਆਂ ਤੋਂ ਵੀ ਕਿਤੇ ਕਿਤੇ ਵੀ ਜੀਅ ਅੱਕ ਜਾਂਦਾ ਅਤੇ ਇਹਦਾ ਸਹੀ ਢੰਗ ਅਤੇ ਵੀ ਸਹੀ ਛੇਤੀ ਤੋਂ ਛੇਤੀ ਇਲਾਜ ਹੋ ਜਾਵੇ ਅਤੇ ਚੰਗੀ ਸਹੀ ਦਵਾਈ ਮਿਲ ਜਾਵੇ ਅਤੇ ਆਪਣਾ ਸਹੀ ਇਲਾਜ ਹੋ ਜ ਸਕਦਾ ਹੈ ਬਹੁਤ ਮੰਗਿਆਈਆਂ ਨੂੰ ਵੇਖ ਕੇ ਹਰ ਇੱਕ ਬੰਦੇ ਨੂੰ ਟੈਂਸ਼ਨਾਂ ਬਣੀਆਂ ਹਰ ਘਰ ਦੇ ਕੰਮ ਤੋਰ ਵੇਖ ਕੇ ਨੂੰ ਸਾਰਿਆਂ ਨੂੰ ਟੈਂਸ਼ਨਾਂ ਬਣੀਆਂ ਵੀ ਅੱਜ ਕੱਲ੍ਹ ਵੱਡੇ ਛੋਟੇ ਨੂੰ ਬੱਚਿਆਂ ਨੂੰ ਪੜ੍ਹਾਈ ਦੀਆਂ ਅਤੇ ਸਿਆਣਿਆ ਬੰਦਿਆਂ ਨੂੰ ਆਪਣੇ ਕੰਮਾਂ ਧੰਦਿਆਂ ਦੀਆਂ ਹਰ ਇੱਕ ਨੂੰ ਟੈਂਸ਼ਨਾਂ ਬਣੀਆ ਅਤੇ ਟੈਸ਼ਨ ਤੋਂ ਰਹਿਤ ਰਹਿਣ ਦੇ ਲਈ ਚੰਗੀ ਕੋਈ ਦਵਾਈ ਅਤੇ ਚੰਗੀ ਕੋਈ ਬੱਚਿਆਂ ਨੂੰ ਸਿਹਤ ਸੰਭਾਲ ਦਿੱਤੀ ਜਾਵੇ ਅਤੇ ਆਪਣਾ ਇਹ ਟੈਂਸ਼ਨਾਂ ਤੋਂ ਚਿੰਤਾ ਤੋਂ ਦੂਰ ਰਹਿ ਸਕੇ ਅਤੇ ਸਾਨੂੰ ਬਹੁਤ ਹਾਨੀਕਾਰਕ ਹੈ ਸਾਰਿਆਂ ਲਈ ਦਵਾਈ ਵੀ ਅਤੇ ਟੈਸ਼ਨ ਵੀ ਅਤੇ ਬਹੁਤ ਟੈਂਸ਼ਨਾਂ ਬਣੀਆਂ ਅਤੇ ਗੁਪਤ ਨਾ ਰੱਖਿਆ ਜਾਵੇ ਅਤੇ ਜਿਹਨੂੰ ਵੀ ਟੈਸ਼ਨ ਬਣੀ ਹੈ ਕਈ ਕਈ ਗੁਪਤ ਰੱਖ ਲੈਂਦੇ ਆ ਦੱਸਦੇ ਨਹੀਂ ਅਤੇ ਪਰ ਜੇ ਸਾਰਿਆਂ ਨੂੰ ਇਹ ਗੱਲ ਸਾਂਝੀ ਕੀਤੀ ਜਾਵੇ ਅਤੇ ਇਹਦਾ ਇਲਾਜ ਵੀ ਛੇਤੀ ਹੋ ਸਕਦਾ ਅਤੇ ਆਪਣਾ ਸਹੀ ਢੰਗ ਅਤੇ ਇਲਾਜ ਕਰਵਾਓ ਅਤੇ ਸਾਨੂੰ ਵੀ ਇਸ ਗੱਲ ਦੀ ਬਹੁਤ ਚਿੰਤਾ ਅਤੇ ਟੈਸ਼ਨ ਹੈ ਅਤੇ ਬੱਚਿਆਂ 'ਤੇ ਨਿੱਕੇ ਨਿੱਕਿਆਂ 'ਤੇ ਪਈਆਂ ਪਈਆਂ ਟੈਂਸ਼ਨਾਂ ਅਤੇ ਜਿਹੜੇ ਬੰਦੇ ਨੇ ਆਪਣੀ ਕਬੀਲਦਾਰੀ ਸਾਰੀ ਸਾਂਭਣੀ ਹੈ ਉਹਨਾਂ 'ਤੇ ਤਾਂ ਟੈਸ਼ਨਾਂ ਬਣਨੀਆਂ ਹੀ ਹੈ ਅਤੇ ਨਿੱਕੇ ਨਿੱਕੇ ਬੱਚਿਆਂ 'ਤੇ ਵੀ ਬਣੀਆਂ